ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤਮੰਨਾ ਬੁਟੀਕ ਦੀ ਓਨਰ ਜਸ਼ਨਦੀਪ ਕੌਰ ਗੱਲ ਕਰ ਰਹੀ ਹਾਂ ਹਾਂਜੀ ਸੀਅ ਦੇਵਾਂਗੇ ਤੁਹਾਨੂੰ ਕਿੱਦਾਂ ਕੀ ਕਿੱਦਾਂ ਦੇ ਸੂਟ ਸਵਾਣੇ ਹੈ ਠੀਕ ਹੈ ਜੀ ਸੀਅ ਦੇਵਾਂਗੇ ਹਾਂਜੀ ਜਿਵੇਂ ਦਾ ਤੁਸੀਂ ਡਿਜ਼ਾਇਨ ਕਹੋਂਗੇ ਉਵੇਂ ਦਾ ਹੀ ਸੀਅ ਕੇ ਦੇ ਦੇਵਾਂਗੇ ਤੁਹਾਨੂੰ ਸਿਲਾਈ ਵੈਸੇ ਤਾਂ ਹਜ਼ਾਰ ਰੁਪਏ ਤੋਂ ਸ਼ੁਰੂ ਹੈ ਬਾਕੀ ਤੁਸੀਂ ਇੱਕ ਵਾਰ ਬੁਟੀਕ 'ਤੇ ਆ ਕੇ ਪਤਾ ਕਰ ਲਿਓ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਹਾਂਜੀ ਉਹ ਤੁਸੀਂ ਆ ਆ ਜਾਓ ਇੱਕ ਵਾਰ ਆਪਾਂ ਡਿਸਕਸ ਕਰ ਲਵਾਂਗੇ ਬੁਟੀਕ 'ਤੇ ਹੀ ਡਿਸਕਾਊਂਟ ਵਗੈਰਾ ਤੁਹਾਨੂੰ ਮਿਲ ਜੂਗਾ ਤੁਸੀਂ ਪਹਿਲੀ ਵਾਰ ਸਵਾ ਰਹੇ ਹੋ ਸਾਡਾ ਬੁਟੀਕ ਜੀ ਮੋਹਾਲੀ ਵਿੱਚ ਹੈ ਦੋ ਫੇਸ ਵਿੱਚ ਟਾਈਮਿੰਗ ਜੀ ਨੌ ਵਜੇ ਤੋਂ ਲੈ ਕੇ ਸ਼ਾਮ ਸੱਤ ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਬੁਟੀਕ ਹਾਂਜੀ ਮੇਰੇ ਕਾਫੀ ਦੁਕਾਨਾਂ ਵਿੱਚ ਮਤਲਬ ਵੀ ਹੈਗੇ ਹੈ ਟਾਈਜਅੱਪ ਹੈਗੇ ਅਤੇ ਮੈਂ ਤੁਹਾਨੂੰ ਰਿਕਮੈਂਡ ਕਰ ਲੂੰਗੀ ਕਾਫੀ ਦੁਕਾਨਾਂ ਹੈਗੀਆਂ ਜਿੱਥੇ ਇਨਬਰੋਇਡਰੀ ਦਾ ਕੰਮ ਹੁੰਦਾ ਹੈ ਅਤੇ ਤੁਸੀਂ ਆ ਜਿਓ ਇੱਕ ਵਾਰ ਮੈਂ ਤੁਹਾਨੂੰ ਸੁਜੈਸਟ ਕਰ ਦੇਵਾਂਗੀ ਅਤੇ ਉੱਥੋਂ ਤੋਂ ਤੁਸੀਂ ਕਰਵਾ ਸਕਦੇ ਹੋ ਹਾਂ ਹਾਂਜੀ ਮੈਂ ਤੁਹਾਨੂੰ ਐਡਰੈੱਸ ਵਟਸਐਪ ਕਰ ਦੇਵਾਂਗੀ ਅਤੇ ਸੂਟ ਤੁਹਾਨੂੰ ਟੈਮ 'ਤੇ ਮਿਲ ਜੂੰਗੇ ਤੁਸੀਂ ਇੱਕ ਵਾਰ ਆ ਕੇ ਆਪਣੇ ਦਿਖਾ ਜਿਓ ਮੈਨੂੰ ਕੀ ਕਿੱਦਾਂ ਕਿੱਦਾਂ ਦੇ ਤੁਹਾਨੂੰ ਡਿਜ਼ਾਇਨਸ ਚਾਹੀਦੇ ਨੇ ਠੀਕ ਹੈ ਠੀਕ ਹੈ ਜੀ ਥੈਂ